ਹੈਲੋ ਹਾਂਜੀ ਨਸਮਕਾਰ ਜੀ ਆਪਨੇ ਕੋਲ ਹੈਗਾ ਪੰਜਾਬ ਕੇਸਰੀ ਪੰਜਾਬੀ ਟਰਬਿਊਨ ਅਤੇ ਇੱਕ ਲੋਕਲ ਹੈਗਾ ਕੇਸਰੀ ਅਤੇ ਬਸ ਹਾਂਜੀ ਆਉਂਦੇ ਹੈ ਜੀ ਸੂਬਹੇ ਨੌ ਵਜ੍ਹੇ ਮੈਂ ਜੀ ਪਹਿਲਾਂ ਪਿੱਛੋਂ ਆ ਗਿਆ ਅਖ਼ਬਾਰ ਫੇਰ ਉੱਥੋਂ ਮੈਂ ਗਿਣਤੀ ਕਰਕੇ ਲੈ ਕੇ ਅਤੇ ਫੇਰ ਅਗਲੇ ਦੇ ਘਰੇ ਲੈ ਜੀ ਦਾ ਜੀ ਹਾਂ ਤੁਸੀਂ ਵੀ ਲਓ ਹਾਂ ਤੁਸੀਂ ਲਓਗੇ ਤਾਂ ਫੇਰ ਐਡਜਸਟਮੈਂਟ ਕਰ ਲਵਾਂਗੇ ਠੀਕ ਹੈ ਜੀ ਠੀਕ ਹੈ ਜੀ ਪੰਜਾਂ 'ਚ ਪੰਜਾਬ ਦੀ ਖਬਰਾਂ ਕਿਹਨੇ ਬਣਾਏ ਨਹੀਂ ਜੀ ਨਹੀਂ ਪੇਮੰਟ ਮੰਥਲੀ ਜੀ ਹਾਂਜੀ ਮੰਥਲੀ ਦੀ ਮੰਥਲੀ

ਅਖ਼ਬਾਰ ਦਾ ਪੰਜ ਰੁਪਏ ਜੀ ਇੱਕੋ ਰੇਟ ਹੈ ਜੀ

ਹਾਂਜੀ ਪੁੱਛ ਲਿਆ ਜੀ ਹਾਂ ਕੋਈ ਨਹੀਂ ਆਪਣੇ ਕੋਲ ਸਾਰੇ ਹੈਗੇ ਹਾਂਜੀ

ਹਾਂ ਉਹ ਫਿਰ ਆਪਣੇ ਤੁਹਾਡੇ ਸਭ ਦੇ ਹਿਸਾਬ ਨਾਲ ਪਹਿਲਾਂ ਉਹ ਉੱਧਰ ਗੇੜਾ ਲਾ ਕੇ ਅਤੇ ਉਹ 'ਤੇ ਤੁਹਾਨੂੰ ਟੈਮ ਨਾਲ ਹਾਂ ਜਿਹੜੇ ਕਿ ਭਾਈ ਦਾ ਫੇਰ ਬਜ਼ੁਰਗ ਹੁੰਦੇ ਆ ਘਰੇ ਉਹ ਫਿਰ ਉਹਨਾਂ ਨਾਲ ਅਖ਼ਬਾਰ ਪੜ੍ਹਾ ਉਹ ਘਰੇ ਰਹਿੰਦੇ ਆ ਫੇਰ ਉਹਨਾਂ ਨੂੰ ਲੇਟ ਹੋਜੇ ਤਾਂ ਕੋਈ ਦਿੱਕਤ ਨਹੀਂ ਠੀਕ ਹੈ ਜੀ ਥੈਂਕ ਯੂ